ਜੇਕਰ ਅਸੀਂ ਖੇਡਾਂ ਨੂੰ ਖੇਡ ਦੀ ਭਾਵਨਾ ਨਾਲ ਖੇਡਾਂਗੇ ਤਾਂ ਉਹ ਸਾਡੇ ਜੀਵਨ ਦੇ ਸਮੁੱਚੀ ਗੁਣਵੱਤਾ 'ਤੇ 'ਤੇ ਪੋਜ਼ੀਟਿਵ ਪ੍ਰਭਾਵ ਪਾਉਣਗੀਆਂ ਹੀ ਕਿਉਂਕਿ ਜੇਕਰ ਜਿਵੇਂ ਉਦਾਹਰਨ ਦੇ ਤੌਰ 'ਤੇ ਰ ਰੱਸਾ ਕੱਸੀ ਹੈ ਉਹਦੇ ਵਿੱਚ ਅਸੀਂ ਸਾਰੇ ਜਣੇ ਖਿਚਾਅ ਇੱਕ ਪਾਸੇ ਰੱਸਾ ਖਿੱਚਦੀਆਂ ਦੂਜੀ ਪਾਰਟੀ ਦੂਜੇ ਪਾਸੇ ਰੱਸਾ ਖਿੱਚਦੀ ਹੈ ਅਤੇ ਸਾਨੂੰ ਪਤਾ ਚੱਲ ਜਾਂਦਾ ਵੀ ਏਕੇ ਦੇ ਵਿੱਚ ਜਿਹੜੀ ਹੈਗੀ ਹੈ ਉਹ ਬਰਕਤ ਹੈਗੀ ਹੈ ਇਸ ਕਰਕੇ ਜਿਹੜੀਆਂ ਖੇਡਾਂ ਹੈਗੀਆਂ ਉਹ ਸਾਡੇ ਵਿੱਚ ਪੋਜ਼ਟਿਵ ਗੁਣਵੱਤਾ ਜਿਹੜੀ ਹੈਗੀਆਂ ਉਹ ਪ੍ਰਦਾਨ ਕਰਦੀਆਂ ਹਨ